ਸਿਲਾਈ ਅਤੇ ਬੁਣਾਈ ਨੂੰ ਬਿਹਤਰ ਕਰਨ ਵਾਸਤੇ ਸਾਡੇ ਕੋਲ ਕਈ ਮਸ਼ੀਨਾਂ ਹਨ ਬੁਣਨ ਲਈ ਸਾਡੇ ਕੋਲ ਸਿਲਾਈਆਂ ਹਨ ਸਿਲਾਈਆਂ ਦੇ ਨਾਲ ਨਾਲ ਹੀ ਅੱਜ ਕੱਲ੍ਹ ਮਸ਼ੀਨਾਂ ਹਨ ਜੋ ਸਾਨੂੰ ਸਾਡੇ ਕੰਮ ਨੂੰ ਸੌਖਾ ਕਰ ਦਿੰਦੀਆਂ ਹਨ ਉਹ ਮਸ਼ੀਨ ਵੀ ਹੈ ਮੇਰੇ ਕੋਲ ਔਰ ਸਿਲਾਈ ਕਰਨ ਲਈ ਸਵੀਤ ਲੈਂਪ ਸਈ ਪਲੇਟ ਥਰੈਡ ਗਾਰਡ ਰੋਟਰੀ ਹੁਕ ਇਹ ਸਾਰਾ ਕੁਛ ਮਸ਼ੀਨ ਦੇ ਨਾਲ ਲੱਗਾ ਹੋਇਆ ਹੈ ਜਿਹਦੇ ਨਾਲ ਸਿਲਾਈ ਕਰਨ ਵਿੱਚ ਬਹੁਤ ਸੌਖ ਹੁੰਦੀ ਹੈ ਔਰ ਅੱਜ ਕੱਲ੍ਹ ਇਸ ਨੂੰ ਬਿਹਤਰ ਬਣਾਉਣ ਵਾਸਤੇ ਮੋਟਰ ਲੱਗਣੀ ਸ਼ੁਰੂ ਹੋ ਗਈ ਹੈ ਔਰ ਮੇਰੀ ਮਸ਼ੀਨਾਂ ਮੋਟਰ ਵੀ ਮੈਂ ਹੁਣ ਲਗਵਾਈ ਹੈ ਜਿਹਦੇ ਨਾਲ ਕੰਮ ਸੌਖੇ ਤਰੀਕੇ ਨਾਲ ਹੋ ਜਾਂਦੇ ਹੈ ਆਸਾਨ ਵੀ ਰਹਿੰਦਾ ਹੈ ਔਰ ਜਲਦੀ ਵੀ ਬਣ ਕੇ ਤਿਆਰ ਹੋ ਜਾਂਦਾ ਹੈ